ਸ਼ਹੀਦ ਭਗਤ ਸਿੰਘ ਜ਼ਿਲ੍ਹੇ ਵਿੱਚ ਜਿੱਥੇ ਸਰਕਾਰੀ ਹਸਪਤਾਲ ਨੇ ਉੱਥੇ ਨਾਲ ਨਾਲ ਪ੍ਰਾਈਵੇਟ ਹਸਪਤਾਲ ਵੀ ਮੌਜੂਦ ਨੇ ਜਿਹੜੇ ਕਿ ਆਮ ਲੋਕਾਂ ਨੂੰ ਕੀ ਹੈ ਉਹਨਾਂ ਦੀਆਂ ਸਿਹਤ ਨੂੰ ਲੈ ਕੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਉਹਨਾਂ ਨਾਲ ਨਜਿੱਠਣ ਵਿੱਚ ਕੀ ਹੈ ਮੱਦਦ ਕਰਦੇ ਨੇ ਇਹਨਾਂ ਦੇ ਨਾਲ ਨਾਲ ਇੱਥੇ ਬਹੁਤ ਸਾਰੇ ਕਲੀਨਿਕ ਫਾਰਮੈਸੀਆਂ ਕਮਿਊਨਟੀ ਹੈਲਥ ਸੈਂਟਰ ਵੀ ਮੌਜੂਦ ਨੇ ਜਿਹੜੇ ਜਿੱਥੇ ਕਿ ਜਿਵੇਂ ਆਪਾਂ ਸੁਣਿਆ ਹੀ ਹੈ ਸਾਰਿਆਂ ਨੇ ਕਿ ਹੈਲਥ ਹੌਮ ਕਲੀਨਿਕ ਜਿਹੜੇ ਸਰਕਾਰ ਨੇ ਉਹ ਪ੍ਰੋਵਾਇਡ ਕਰਕੇ ਦਿੱਤੇ ਨੇ ਜਿਹੜੇ ਕਿ ਆਮ ਲੋਕਾਂ ਨੂੰ ਕੀ ਹੈ ਮੁਫ਼ਤ ਵਿੱਚ ਦਵਾਈਆਂ ਪ੍ਰੋਵਾਇਡ ਕਰ ਰਹੇ ਨੇ ਅਤੇ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੋਣ ਕਰਕੇ ਉਹਨਾਂ ਨੂੰ ਬਹੁਤਾ ਦੂਰ ਨਹੀਂ ਜਾਣਾ ਪੈਂਦਾ ਅਤੇ ਉਹ ਆਪਣੀਆਂ ਕੀ ਹੈ ਸਿਹਤ ਨੂੰ ਜਿਹੜੀਆਂ ਸਿਹਤ ਸਮੱਸਿਆਵਾਂ ਨੇ ਉਹਨਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਨੇ ਕੋਵਿਡ ਦੌਰਾਨ ਵੀ ਬਹੁਤ ਜਿਹੜੀ ਕੀ ਹੈ ਇਹ ਮਹਾਂਮਾਰੀ ਫੈਲੀ ਹੋਈ ਸੀ ਉਸ ਦੌਰਾਨ ਵੀ ਹਸਪਤਾਲਾਂ ਅਤੇ ਉਹਨਾਂ ਦੇ ਡੋਕਟਰਾਂ ਅਤੇ ਨਰਸਾਂ ਨੇ ਕੀ ਹੈ ਇਸ ਬਿਮਾਰੀ ਨਾਲ ਨਜਿੱਠਣ ਵਿੱਚ ਆਮ ਲੋਕਾਂ ਦੀ ਬਹੁਤ ਮਦਦ ਕੀਤੀ ਹੈ ਜਿਹਦੇ ਵਿੱਚ ਕੀ ਹੈ ਆਮ ਲੋਕ ਇੱਕ ਦੂਸਰੇ ਨੂੰ ਆਪਣੇ ਘਰ ਦੇ ਵੀ ਇੱਕ ਦੂਸਰੇ ਤੋਂ ਦੂਰ ਰਹਿ ਰਹੇ ਸੀ ਉ ਉਸ ਏਸ ਬਿਮਾਰੀ ਦੌਰਾਨ ਕੀ ਹੈ ਡਾਕਟਰਾਂ ਨੇ ਆਮ ਲੋਕਾਂ ਦੀ ਮਦਦ ਕੀਤੀ ਅਤੇ ਉਹਨਾਂ ਨੂੰ ਇਸ ਬ ਮਹਾਂਮਾਰੀ ਨਾਲ ਨਜਿੱਠਣ ਵਿੱਚ ਮਦਦ ਕੀਤੀ